ਪੰਜਾਬ ਵਿੱਚ ਜਨਮ ਦੇ ਸਮੇਂ ਹੋਰ ਰੀਤੀ ਰਿਵਾਜ ਹੈ ਵਿਆਹ ਦੇ ਸਮੇਂ ਹੋਰ ਰੀਤੀ ਰਿਵਾਜ ਹੈ ਅਤੇ ਮਰਨ ਦੇ ਸਮੇਂ ਹੋਰ ਰੀਤੀ ਰਿਵਾਜ ਹੈ